ਮੈਂ ਜਿਹੜੀ ਡਰੈਸ ਮੰਗਾਈ ਆਨਲਾਈਨ ਡਰੈਸ ਮੈਂ ਆਰਡਰ ਕੀਤੀ ਸੀ ਹੁਣ ਮੈਂ ਉਹਨੂੰ ਰੱਦ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਉਸਦੀ ਜ਼ਰੂਰਤ ਨਹੀਂ ਆ ਉਸਦਾ ਸਭ ਤੋਂ ਪਹਿਲਾਂ ਤਾਂ ਉਸਦਾ ਰੱਦ ਕਰਨ ਦਾ ਕਾਰਨ ਇਹ ਦੱਸਾਂਗੀ ਮੈਂ ਕਿ ਮੈਂ ਜਿਹੜੀ ਡਰੈਸ ਮੰਗਾਈ ਸੀ ਉਹ ਮੈਂ ਵੈਸਟਰਨ ਮੰਗਾਈ ਸੀ ਮਤਲਬ ਜੋ ਪੱਛਮੀ ਇਲਾਕਿਆਂ 'ਚ ਪਾਉਂਦੇ ਆ ਗਾਊਨ ਜਿਹਨੂੰ ਕਹਿੰਦੇ ਆ ਉਹ ਮੈਂ ਮੰਗਾਇਆ ਸੀ ਕਿ ਹੁਣ ਮੈਨੂੰ ਜਿੱਥੇ ਮੈਂ ਜਾਣਾ ਸੀ ਉੱਥੇ ਉਸ ਪਾਰਟੀ ਦੀ ਥੀਮ ਜਿੱਦਾਂ ਕਿ ਕਹਿ ਲਓ ਬਦਲ ਗਈ ਉਹ ਥੀਮ ਪਾਰਟੀ ਸੀ ਥੀਮ ਚੇਂਜ ਹੋ ਗਈ ਕਿ ਥੀਮ ਬਦਲ ਗਈ ਅਤੇ ਮੈਨੂੰ ਹੁਣ ਉੱਥੇ ਟਰਡੀਸ਼ਨਲ ਪਾਉਣਾ ਏ ਪੰਜਾਬੀ ਸੂਟ ਸਲਵਾਰ ਪਾਉਣਾ ਸੀ ਅਤੇ ਇਸ ਕਰਕੇ ਜੇ ਮੈਂ ਐ ਕਾਰਨ ਦੱਸਾਂਗੀ ਕਿ ਮੇਰੀ ਪਾਰਟੀ ਦੀ ਥੀਮ ਚੇਂਜ ਹੋ ਗਈ ਆ ਕਿ ਜਿੱਥੇ ਕਿ ਮੈਂ ਵੈਸਟਰਨ ਗਾਊਨ ਮੰਗਾਇਆ ਸੀ ਓਹਦੀ ਥਾਂ 'ਤੇ ਮੈਨੂੰ ਹੁਣ ਪੰਜਾਬੀ ਸੂਟ ਸਲਵਾਰ ਚਾਹੀਦਾ ਸੀ ਇਸ ਕਰਕੇ ਮੈਂ ਆਪਣਾ ਆਰਡਰ ਰੱਦ ਕਰ ਕ ਕੀਤਾ ਹੈ ਅਤੇ ਉਹਦੇ ਲਈ ਮੈਂ ਰੱਦ ਕਰਨ ਲਈ ਮੈਂ ਕਦਮ ਐਹ ਚੁੱਕਾਂਗੀ ਸਭ ਤੋਂ ਪਹਿਲਾਂ ਤਾਂ ਮੈਂ ਫਿਰ ਡਰੈਕਟ ਜਿੱਥੋਂ ਮੈਂ ਆਨਲਾਈਨ ਮੰਗਾਇਆ ਮੈਂ ਉਹਦੇ ਕੋਲ ਉਹਨੂੰ ਕੋਂਟੈਕਟ ਕਰਾਂਗੀ ਅਤੇ ਅਗਰ ਅਤੇ ਉਹ ਵੀ ਮੇਰੀ ਹੈਲਪ ਨਹੀਂ ਕਰਦਾ ਉਹ ਕੈਂਸਲ ਨਹੀਂ ਕਰਦਾ ਕਿਉਂਕਿ ਮੈਂ ਔਨਲਾਈਨ ਪੇਮੈਂਟ ਕੀਤੀ ਹੋਈ ਆ ਅਗਰ ਤਾਂ ਉਹ ਮੇਰੀ ਮਦਦ ਨਹੀਂ ਕਰੇਗਾ ਕਿਉਂਕਿ ਉਸ ਤੋਂ ਬਾਅਦ ਮੈਂ ਜਾਵਾਂਗੀ ਆਪਣੀ ਜਿੱਥੋਂ ਕਿ ਮੈਂ ਆਪਣੀ ਈਮੇਲ ਐਪ ਹੈ ਜਿਸ ਐਪ ਤੋਂ ਮੈਂ ਆਨਲਾਈਨ ਮੰਗਵਾਇਆ ਸੀ ਮੈਂ ਐਪ 'ਤੇ ਮੇਲ ਪਾਵਾਂਗੀ ਫਿਰ ਮੈਂ ਸੈਲਰ ਨੂੰ ਕੋਂਟੈਕਟ ਕਰਾਂਗੀ ਅਤੇ ਮੈਂ ਉਹਨਾਂ ਨੂੰ ਔਰ ਕਸਟਮਰ ਕੇਅਰ ਜਿਹੜਾ ਨੰਬਰ ਮਿਲਦਾ ਏ ਮੈਂ ਉੱਥੇ ਵੀ ਆਪਣੀ ਸ਼ਿਕਾਇਤ ਦਰਜ ਕਰਾਂਗੀ ਅਤੇ ਉਹਨਾਂ ਨੂੰ ਤਾਂ ਡਰੈਕਟ ਮੈਂ ਵੈਸੇ ਤਾਂ ਮੈਂ ਡਾਇਰੈਕਟ ਸੈਲਰ ਨਾਲ ਹੀ ਕੰਟੈਕਟ ਕਰਾਂਗੀ ਕਿ ਜਿੱਥੇ ਕਿ ਮੇਰੀ ਔ ਜਿਹੜੀ ਮੈਂ ਆਨਲਾਈਨ ਡਰੈਸ ਆਰਡਰ ਕੀਤੀ ਆ ਓ ਮੇਰਾ ਓਡਰ ਰੱਦ ਕੀਤਾ ਜਾਏ ਇਹੀ ਕਦਮਾਂ ਦੇ ਇਹੀ ਕਦਮ ਜੋ ਹੈ ਕਿ ਮੈਂ ਚੁੱਕ ਸਕਦੀ ਹਾਂ ਆਪਣੀ ਡਰੈਸ ਨੂੰ ਰੱਦ ਕਰਨ ਲਈ ਆਰਡਰ ਨੂੰ ਰੱਦ ਕਰਨ ਲਈ ਧੰਨਵਾਦ